ਪੰਜਾਬੀ ਪੰਜਾਬ ਦੇ ਲੋਕਾਂ ਦੀ ਭਾਸ਼ਾ ਹੈ ਪੰਜਾਬ ਦੇ ਲੋਕ ਆਪਣੇ ਪਰਿਵਾਰਾਂ ਘਰਾਂ ਗਲੀਆਂ ਮੁਹੱਲਿਆਂ ਅਤੇ ਸੱਥਾਂ ਪਰਿਆਂ ਵਿੱਚ ਪੰਜਾਬੀ ਭਾਸ਼ਾ ਹੀ ਬੋਲਦੇ ਹਨ ਸਾਨੂੰ ਮਾਂ ਦੇ ਦੁੱਧ ਨਾਲ਼ ਹੀ ਪੰਜਾਬੀ ਦੀ ਗੁੜ੍ਹਤੀ ਮਿਲਦੀ ਹੈ ਅਤੇ ਅਸੀਂ ਛੋਟੀ ਉਮਰ ਵਿੱਚ ਹੀ ਮਾਪਿਆਂ ਭੈਣ ਭਰਾਵਾਂ ਸ਼ਰੀਕੇ ਕਬੀਲੇ ਦੇ ਬੰਦਿਆਂ ਤੋਂ ਪੰਜਾਬੀ ਬੋਲਣਾ ਅਤੇ ਸਮਝਣਾ ਸਿੱਖ ਲੈਂਦੇ ਹਾਂ ਬਚਪਨ ਤੋਂ ਹੀ ਅਸੀਂ ਪੰਜਾਬੀ ਵਿੱਚ ਸੋਚਦੇ ਗੱਲ ਬਾਤ ਕਰਦੇ ਅਤੇ ਨਿੱਤਾ ਪ੍ਰਥ ਕਾਰ ਵਿਹਾਰ ਨੂੰ ਚਲਾਉਂਦੇ ਰਹਿੰਦੇ ਹਾਂ ਫਿਰ ਵੱਡੇ ਹੋ ਕੇ ਵੀ ਅਸੀਂ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਦੇ ਸਹਾਰੇ ਵਿੱਦਿਆ ਗ੍ਰਹਿਣ ਕਰਦੇ ਹਾਂ ਹੋਰ ਤਾਂ ਹੋਰ ਸਾਡੀਆਂ ਰੀਤਾਂ ਅਤੇ ਰਸਮਾਂ ਮੇਲੇ ਅਤੇ ਤਿਉਹਾਰ ਮੰਨਤਾਂ ਅਤੇ ਮਨੋਤਾਂ ਸਾਡਾ ਗੀਤ ਸੰਗੀਤ ਸਾਡੇ ਕਿੱਸੇ ਕਹਾਣੀਆਂ ਸਾਰਾ ਕੁਝ ਪੰਜਾਬੀ ਦੇ ਆਸਰੇ ਹੀ ਪੂਰਾ ਹੁੰਦਾ ਹੈ ਇਸ ਤੋਂ ਵੀ ਅੱਗੇ ਸਾਡੇ ਆਲੇ ਦੁਆਲੇ ਅਤੇ ਦੂਰ ਦੂਰ ਤੱਕ ਜੋ ਵੀ ਸੰਸਾਰ ਪੱਸਰਿਆ ਹੋਇਆ ਹੈ ਉਸ ਨਾਲ਼ ਸਾਡੀ ਸਾਂਝ ਅਤੇ ਜਾਣ ਪਛਾਣ ਪੰਜਾਬੀ ਰਾਹੀਂ ਹੀ ਹੁੰਦੀ ਹੈ ਗੱਲ ਕੀ ਗੁੱਸੇ ਅਤੇ ਪਿਆਰ ਵਿੱਚ ਰੋਣੇ ਅਤੇ ਹਾਸੇ ਵਿੱਚ ਖੁਸ਼ੀ ਅਤੇ ਗਮੀ ਵਿੱਚ ਪੰਜਾਬੀ ਬੋਲੀ ਹੀ ਸਾਡਾ ਸਹਾਰਾ ਹੁੰਦੀ ਹੈ